ਜ਼ਿੰਦਗੀ ਵਿੱਚ ਕਲਾ ਬਹੁਤ ਵੱਡੀ ਭੂਮਿਕਾ ਰੱਖਦੀ ਹੈ ਕਿਉਂਕਿ ਇਸ ਨਾਲ ਬੰਦਾ ਆਪਣੇ ਡਰੀਮਜ਼ ਨੂੰ ਪੂਰਾ ਕਰ ਸਕਦਾ ਹੈ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਕੂਕਿੰਗ ਦਾ ਬਹੁਤ ਸ਼ੌਂਕ ਹੈ ਜੀ ਮੇਰੇ ਕੂਕਿੰਗ ਇੱਕ ਕਲਾ ਹੈ ਮੇਰੇ ਲਈ ਕੂਕਿੰਗ ਇੱਕ ਕਲਾ ਹੈ ਜਿਸ ਨਾਲ ਮੈਂ ਅਲੱਗ ਅਲੱਗ ਤਰੀਕੇ ਦੇ ਵਿਅੰਜਨ ਵਗੈਰਾ ਬਣਾਉਂਦਾ ਰਹਿੰਦਾ ਹਾਂ ਅਤੇ ਉਹਨਾਂ ਨੂੰ ਹਰੇਕ ਨੂੰ ਟੇਸਟ ਵਗੈਰਾ ਕਰਵਾਉਂਦਾ ਰਹਿੰਦਾ ਹਾਂ ਘਰਦਿਆਂ ਨੂੰ ਕੁਛ ਨਾ ਕੁਛ ਮੈਂ ਯੂਟਿਊਬ ਤੋਂ ਵਗੈਰਾ ਤੋਂ ਸਿੱਖਦਾ ਰਹਿੰਦਾ ਹਾਂ ਅਤੇ ਆਹ ਕੁਛ ਨਾ ਕੁਛ ਨਿਊ ਰੋਜ਼ ਐਕਸਪੈਰੀਮੈਂਟ ਕਰਕੇ ਬਣਾਉਂਦਾ ਰਹਿੰਦਾ ਹਾਂ ਖਾਣੇ ਨਾਲ ਮੈਨੂੰ ਇੰਨਾਂ ਜ਼ਿਆਦਾ ਲਗਾਵ ਹੋ ਗਿਆ ਹੈ ਕਿ ਮੈਂ ਹੁਣ ਆਪਣਾ ਖੁਦ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹਾਂ ਜਿਹਦੇ ਵਿੱਚ ਰੈਸਟੋਰੈਂਟ ਵਿੱਚ ਮੈਂ ਬੱਫ਼ੇ ਸਿਸਟਮ ਰੱਖਾਗਾਂ ਜਿਹਦੇ ਵਿੱਚ ਇੱਕ ਇੱਕ ਫਿਕਸ ਐਮਾਊਂਟ ਰੱਖ ਕੇ ਬੰਦੇ ਨੂੰ ਅਨਲਿਮਿਟਿਡ ਫੂ਼ਡ ਪ੍ਰੈਫ਼ਰ ਕਰਾਗਾਂ ਜਿਹਦੇ ਨਾਲ ਵਿੱਚ ਬੰਦਾ ਆਵੇ ਅਤੇ ਉਹਨੂੰ ਆਹ ਤਿੰਨ ਚਾਰ ਤਰੀਕੇ ਦੀ ਆਇਟਮਾਂ ਜਿਵੇਂ ਕਿ ਅੱਜ ਕੱਲ੍ਹ ਡੇਢ ਦੋ ਸੌ ਰੁਪਏ ਵਿੱਚ ਇੱਕ ਥਾਲੀ ਵੀ ਨਹੀਂ ਮਿਲਦੀ ਪਰ ਮੈਂ ਇੰਨੇ ਰੁਪਏ ਦੇ ਵਿੱਚ ਉਹਨੂੰ ਪੰਜ ਸੱਤ ਤਰੀਕੇ ਵੀਹ ਪੱਚੀ ਤਰੀਕੇ ਦੀਆਂ ਆਇਟਮਾਂ ਪ੍ਰੋਵਾਈਡ ਕਰ ਦੇਵਾਗਾਂ ਜਿਹਦੇ ਵਿੱਚ ਚਾਇਨੀਜ਼ ਵਗੈਰਾ ਵੀ ਹੋਵੇਗਾ ਚਪਾਤੀ ਵਗੈਰਾ ਰਾਈਸ ਤਿੰਨ ਚਾਰ ਤਰੀਕੇ ਦੀਆਂ ਸਬਜ਼ੀਆਂ ਸਾਰਾ ਕੁਛ ਵਿੱਚ ਹੋਵੇਗਾ ਅਤੇ ਬੰਦਾ ਆਰਾਮ ਨਾਲ ਆਵੇ ਆਪਣਾ ਇੰਨਜੋਆਏ ਕਰੇ ਅਤੇ ਖੁੱਲ ਕੇ ਖਾ ਪੀ ਵੀ ਕੇ ਐਸ਼ ਕਰਕੇ ਆਪਣਾ ਜਾਵੇ